ਹੈਲੋ ਹਾਂਜੀ ਸਤਨਾਮ ਟਰੈਵਲ ਤੋਂ ਹਾਂਜੀ ਮੈਂ ਨਾ ਰਾਜਵਿੰਦਰ ਕੌਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੋਲ ਰਹੀ ਹਾਂ ਮੈਂ ਨਾ ਇੱਕ ਤੁਹਾਡੀ ਕੈਬ ਬੁੱਕ ਕੀਤੀ ਸੀ ਅਤੇ ਮੈਂ ਜਾਣਾ ਸੀ ਏਅਰਪੋਰਟ ਤੱਕ ਪਰ ਤੁਹਾਡੀ ਐਨੀ ਸਰਵਿਸ ਘਟੀਆ ਨਾ ਤੁਹਾਡਾ ਡਰਾਈਵਰ ਆਇਆ ਨਾ ਹੀ ਉਹਨੇ ਫੋਨ ਚੁੱਕਿਆ ਇਹ ਕਿੱਡੀ ਗਲਤ ਗੱਲ ਹੈ ਜਦੋਂ ਕਿ ਅਸੀਂ ਇਸੇ ਉਹਦੇ ਵਿੱਚ ਬੈਠੇ ਹਾਂ ਕਿ ਨਹੀਂ ਜੀ ਸਾਡੀ ਗੱਲਬਾਤ ਹੋ ਗਈ ਅਸੀਂ ਕੋਲ ਕਰ ਦਿੱਤੀ ਹੈ ਕਿ ਉਹਨਾਂ ਨੇ ਆ ਜਾਣਾ ਪਰ ਦੇਖੋ ਮੇਰੇ ਸਾਰੇ ਹੀ ਪ੍ਰੋਗਰਾਮ ਜਿਹੜਾ ਉਹ ਨਾ ਮਿਸ ਹੋ ਗਿਆ ਮੈਂ ਜਾਣਾ ਸੀ ਏਅਰਪੋਰਟ ਤੱਕ ਨਾ ਮੈਨੂੰ ਟੈਕਸੀ ਆਈ ਨਾ ਡਰਾਈਵਰ ਨੇ ਫੋਨ ਚੁੱਕਿਆ ਅੱਗੋਂ ਮੇਰੀ ਫਲਾਈਟ ਵੀ ਕੈਂਸਲ ਹੋ ਗਈ ਅਤੇ ਅੱਗੇ ਜਾ ਕੇ ਮੀਟਿੰਗ ਸੀਗੀ ਅਤੇ ਉਹ ਵੀ ਕੈਂਸਲ ਹੋ ਗਈ ਹੁਣ ਦੱਸੋ ਹੁਣ ਕਰੀਏ ਤਾਂ ਕੀ ਕਰੀਏ ਉੱਧਰੋਂ ਮੇਰੇ ਜਿਹੜਾ ਫਲਾਈਟ ਦਾ ਜਿਹੜਾ ਖਰਚਾ ਸੀ ਸਾਰਾ ਟਿਕਟ ਦਾ ਉਹ ਵੀ ਗਿਆ ਮੇਰੀ ਮੀਟਿੰਗ ਵੀ ਗਈ ਅਤੇ ਤੁਹਾਡੀ ਕੈਬ ਦਾ ਕੋਈ ਰਿਸਪੋਂਸ ਨਹੀਂ ਆਇਆ ਇਹ ਗਲਤ ਗੱਲਾਂ ਨੇ ਭਾਅ ਜੀ ਅੱਗੇ ਵਾਸਤੇ ਅੱਗੋਂ ਦੱਸੋ ਅਸੀਂ ਕਿਸੇ ਨੂੰ ਹੋਰ ਤੁਹਾਡੀ ਜਿਹੜੀ ਇਹ ਹੈਗੀ ਹੈਗੀ ਤੁਹਾਡੀ ਏਜੰਸੀ ਬਾਰੇ ਜਾਂ ਤੁਹਾਡੀ ਕੈਬ ਬਾਰੇ ਅਸੀਂ ਕਿਸੇ ਨੂੰ ਕੀ ਪੋਜੀਟਿਵ ਰਿਸਪੋਂਸ ਦਿਆਂਗੇ ਇਹ ਗਲਤ ਗੱਲਾਂ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਤੁਹਾਡੇ ਸਾਰੇ ਹੀ ਜਿਹੜੇ ਮੇਰਾ ਤਾਂ ਸਾਰਾ ਪ੍ਰੋਗਰਾਮ ਆ ਜਿਹੜਾ ਉਹ ਕੈਂਸਲ ਹੋ ਗਿਆ ਇਹ ਗਲਤ ਗੱਲਾਂ ਨੇ ਇਸ ਤਰ੍ਹਾਂ ਨਾ ਕਰਿਆ ਕਰੋ